ਹਰ ਸ਼ਹਿਰ ਜਾਂ ਜ਼ਿਲ੍ਹੇ ਵਿੱਚ ਸਬਜ਼ੀ ਲਏ ਮੰਡੀਆਂ ਬਣੀਆਂ ਹੁੰਦੀਆਂ ਨੇ ਅੰਮ੍ਰਿਤਸਰ ਵਿੱਚ ਹੌਲ ਬਜ਼ਾਰ ਦੇ ਲਾਗੇ ਪੁਰਾਣੀ ਸਬਜ਼ੀ ਮੰਡੀ ਹੈ ਆਹ ਸਬਜ਼ੀ ਮੰਡੀ ਬਹੁਤ ਪੁਰਾਣੀ ਹੈਗੀ ਜਿੱਥੇ ਪਿੰਡ ਦੇ ਸਾਰੇ ਲੋਕ ਆਪਣੀਆਂ ਆਪਣੀਆਂ ਸਬਜ਼ੀਆਂ ਲੇਕਰ ਵੇਚਣ ਆਉਂਦੇ ਨੇ ਇੱਥੇ ਸਾਨੂੰ ਤਾਜ਼ੀ ਸਬਜੀ ਚੰਗੇ ਰੇਟਾਂ 'ਤੇ ਮਿਲ ਜਾਂਦੀ ਹੈ ਇੱਥੇ ਤੁਹਾਨੂੰ ਆਲੂ ਗੋਭੀ ਟਮਾਟਰ ਜਿਹੀਆਂ ਸਬਜ਼ੀਆਂ ਤੋਂ ਲੈ ਕੇ ਆਲੂ ਪਿਆਜ਼ ਮਿਰਚੀ ਇਹ ਸਾਰੀ ਚੀਜ਼ਾਂ ਆਰਾਮ ਨਾਲ ਮਿਲ ਜਾਂਦੀਆਂ ਨੇ ਸਾਰੀ ਚੀਜ਼ਾਂ ਇੱਕ ਹੀ ਥਾਂ 'ਤੇ ਮਿਲ ਜਾਂਦੀਆਂ ਨੇ ਇਸ ਕਰਕੇ ਆਪਣਾ ਸੌਦਾ ਲਿਆਉਣ ਵਿੱਚ ਅੱਪਾਂ ਨੂੰ ਘੱਟ ਦਿੱਕਤ ਹੁੰਦੀ ਹੈ ਹੁਣ ਪਿੱਛੇ ਜਿਹੇ ਜਦ ਤੋਂ ਬਾਰਿਸ਼ਾਂ ਪਈਆਂ ਨੇ ਮੀਂਹ ਪੈਣ ਤੋਂ ਬਾਅਦ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਗਏ ਹੈਗੇ ਜਿਹੜੀ ਚੀਜ਼ ਪਹਿਲਾਂ ਦਸ ਰੁਪਈਏ ਦੀ ਮਿਲਦੀ ਸੀਗੀ ਹੁਣ ਉਹ ਪੰਜਾਹ ਰੁਪਏ ਦੀ ਹੋ ਗਈ ਆ ਇਹਦੇ ਨਾਲ ਹੀ ਰਾਸ਼ਨ ਦੀ ਮੰਡੀ ਹੈਗੀ ਆ ਜਿਹਤੋਂ ਅਸੀਂ ਆਪਣਾ ਮੰਥਲੀ ਰਾਸ਼ਨ ਲੈ ਕੇ ਆਉਂਦੇ ਸੀਗੇ ਹੁਣ ਤਾਂ ਔਨਲਾਈਨ ਵੀ ਰਾਸ਼ਨ ਮਿਲਣਾ ਸ਼ੁਰੂ ਹੋ ਗਿਆ ਹੈ ਜਿਵੇਂ ਆਪਣਾ ਐਮਾਜ਼ੋਨ ਜੀਓ ਮਾਟ ਇਹ ਸਾਰੇ ਸਾਨੂੰ ਔਨਲਾਈਨ ਰਾਸ਼ਨ ਦਿੰਦੇ ਨੇ ਇੱਥੇ ਗੱਲ ਬੜੀ ਵਧਿਆ ਹੈਗੀ ਆਪਾਂ ਘਰ ਬੈਠੇ ਰਾਸ਼ਨ ਓਡਰ ਕਰ ਸਕਦੇ ਹਾਂ ਆਪਾਂ ਆਪਣੇ ਲੋੜ ਦੀ ਚੀਜ਼ਾਂ ਨੂੰ ਦੇਖ ਕੇ ਉਹਦੇ ਰੇਟ ਨੂੰ ਦੇਖ ਕੇ ਓਡਰ ਦੇ ਕੇ ਅਤੇ ਆਪਣਾ ਇੱਕ ਵਾਰੀ ਜਦ ਆਪਾਂ ਹੋਮ ਡਿਲੀਵਰੀ ਪਾ ਦਈਏ ਤਾਂ ਉਹ ਰਾਸ਼ਨ ਲੈ ਕੇ ਘਰ ਆ ਜਾਂਦਾ ਹੈ ਔਨਲਾਈਨ ਰਾਸ਼ਨ ਮੰਗਾਉਣ ਦੇ ਦੋ ਦਿੱਕਤ ਹੈਗੀਆਂ ਇੱਕ ਤਾਂ ਉਹਦੀ ਕੁਆਲਿਟੀ ਆਪਾਂ ਨੂੰ ਨਹੀਂ ਪਤਾ ਚੱਲ ਸਕਦੀ ਅਤੇ ਦੂਜਾ ਕਈ ਵਾਰੀ ਜਿਹੜੀ ਚੀਜ਼ਾਂ ਦੀ ਐਕਸਪਾਇਰੀ ਬੜੀ ਨੇੜੇ ਹੁੰਦੀ ਹੈ ਇਹ ਇੱਦਾਂ ਦੀ ਚੀਜ਼ਾਂ ਡਿਸਕਾਊਂਟ 'ਤੇ ਸਾਨੂੰ ਦੇ ਦਿੰਦੇ ਨੇ